ਪੰਜਾਬ ਵਿੱਚ ਐਜੂਕੇਸ਼ਨ ਦੇ ਵਿੱਚ ਜੋ ਚੇਂਜਿਸ਼ ਆਈਆਂ ਨੇ ਜਾਂ ਜਿਨ੍ਹਾਂ ਦੇ ਉੱਪਰ ਉਹ ਫੋਕਸ ਕਰ ਰਹੇ ਨੇ ਉਹ ਇਹ ਕਿ ਚੇਂਜਿਸ਼ ਤਾਂ ਇਹ ਨੇ ਕਿ ਪਹਿਲਾਂ ਸਿਰਫ ਔਰ ਸਿਰਫ ਟੀਚਰ ਔਰ ਸਟੂਡੈਂਟ ਵਾਲਾ ਇੱਕ ਪੈਡਾਗੋਗੀ ਮੈਥਡ ਯੂਜ ਕਰ ਰਹੇ ਸੀਗੇ ਕਿ ਸਿਰਫ ਟੀਚਰ ਬੋਲਦਾ ਅਤੇ ਸਟੂਡੈਂਟਸ ਜਿਹੜੇ ਨੇ ਉਹ ਸਿੱਖਦੇ ਨੇ ਬਟ ਅੱਜ ਕੱਲ੍ਹ ਇਹ ਹੈ ਕਿ ਅੱਜ ਕੱਲ੍ਹ ਐਕਟੀਵਿਟੀ ਬੇਸਡ ਹੋ ਗਿਆ ਐਕਟੀਵਿਟੀਜ ਬੱਚਿਆਂ ਨੂੰ ਕਰਵਾਉਂਦੇ ਨੇ ਤਾਂ ਉਹਦੇ ਤੋਂ ਬੱਚੇ ਜਿਹੜੇ ਨੇ ਉਹ ਜ਼ਿਆਦਾ ਸਿੱਖਦੇ ਨੇ ਪ੍ਰੈਕਟੀਕਲ ਅਪਰੋਚ ਜ਼ਿਆਦਾ ਫੋਲੋ ਕਰ ਰਹੇ ਨੇ ਜੋ ਕਿ ਬੜੀ ਵਧੀਆ ਗੱਲ ਹੈ ਕਿ ਜਦੋਂ ਪ੍ਰੈਕਟੀਕਲ ਅਪਰੋਚ 'ਚ ਬੱਚੇ ਸਿਰਫ ਥਰੈਟਿਕਲ ਨਹੀਂ ਰਹਿ ਗਏ ਨੇ ਕਿ ਸਿਰਫ ਥਿਊਰੀ ਸਿੱਖੀ ਜਾਣ ਉਹਨਾਂ ਨੂੰ ਪਤਾ ਨਾ ਚੱਲੇ ਕਿ ਕਿਹੜੀ ਚੀਜ਼ ਕਿੱਦਾਂ ਵਰਕ ਕਰਦੀ ਹੈ ਤੋ ਉਹ ਚੀਜ਼ਾਂ ਦੀ ਇੰਪਲੀਮੈਂਟੇਸ਼ਨ ਅੱਜ ਕੱਲ੍ਹ ਹੋ ਰਹੀ ਹੈ ਜੋ ਕਿ ਬਹੁਤ ਅੱਛੀ ਚੀਜ਼ ਹੈ ਸਟੂਡੈਂਟਸ ਔਰ ਟੀਚਰ ਦੇ ਰਿਲੇਸ਼ਨਸ਼ਿਪਜ਼ ਜਿਹੜੇ ਨੇ ਉਹ ਕਾਫ਼ੀ ਮਜ਼ਬੂਤ ਹੋ ਰਹੇ ਨੇ ਕਿਉਂਕਿ ਇਹ ਹੈ ਕਿ ਟੀਚਰਸ ਜਿਹੜੇ ਨੇ ਉਹ ਬੱਚਿਆਂ ਨੂੰ ਕਾਫ਼ੀ ਕੁਛ ਸਿਖਾ ਰਹੇ ਨੇ ਜਿੰਨਾ ਟੀਚਰ ਆਪਣੀ ਐਜੂਕੇਸ਼ਨ ਦੇ ਉੱਪਰ ਫੋਕਸ ਕਰ ਰਿਹਾ ਉੰਨਾ ਹੀ ਉਹ ਅੱਗੇ ਬੱਚਿਆਂ ਨੂੰ ਆਪਣੀ ਨੌਲੇਜ ਜਿਹੜੀ ਹੈ ਇੰਪਾਰਟ ਕਰ ਰਿਹਾ ਪੁਰਾਣੇ ਵਾਲੇ ਸੀਗੇ ਕਿ ਜੋ ਉਹਨਾਂ ਨੇ ਪੜ੍ਹ ਲਿਆ ਉਹ ਹੀ ਉਹਨਾਂ ਨੇ ਸਿੱਖ ਲਿਆ ਹੋਰ ਕੁਛ ਨਵੀਆਂ ਚੀਜ਼ਾਂ ਨਹੀਂ ਸਿੱਖ ਰਹੇ ਨੇ ਬਟ ਹੁਣ ਇਹ ਹੈ ਕਿ ਹਾਂ ਟੀਚਰਸ ਖੁਦ ਵੀ ਉਹਨਾਂ ਨੂੰ ਵੀ ਇੰਟਰਸਟ ਹੈਗਾ ਕਿ ਅਸੀਂ ਕੁਛ ਨਵਾਂ ਸਿੱਖੀਏ ਅਤੇ ਉਹ ਬੱਚਿਆਂ ਨੂੰ ਸਿਖਾਈਏ ਕਿੱਦਾਂ ਨਵੀਆਂ ਨਵੀਆਂ ਐਕਟੀਵਿਟੀਜ਼ ਕਰਾਉਣੀਆਂ ਨੇ ਨਵੀਆਂ ਨਵੀਆਂ ਚੀਜ਼ਾਂ ਸਿੱਖਣੀਆਂ ਨੇ ਪ੍ਰੈਕਟੀਕਲ ਜਿੱਦਾਂ ਕੰਪਿਊਟਰਸ ਦੇ ਨੇ ਵਰਡ ਦੇ ਵਿੱਚ ਨਵੀਆਂ ਚੀਜ਼ਾਂ ਬਣਾ ਕੇ ਦੇਖਣੀਆਂ ਐਕਸਲ ਦੇ ਵਿੱਚ ਫੋਰਮੂਲਾਜ ਕ੍ਰੀਏਟ ਕਰਨੇ ਆ ਪ੍ਰੇਸੇੰਟਸ਼ੰਸ ਬਣਾਉਣੀਆਂ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਾਫ਼ੀ ਐਕਸਪੈਂਡ ਹੋ ਰਹੀਆਂ ਨੇ ਤੋ ਅੱਜ ਕੱਲ੍ਹ ਸਟੱਡੀ ਦਾ ਮਿਆਰ ਜਿਹੜਾ ਉਹ ਕਾਫ਼ੀ ਉੱਚਾ ਹੋ ਗਿਆ ਅਗਰ ਪੰਜਾਬ ਦੇ ਵਿੱਚ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਅੱਗੇ ਪ੍ਰੋਜੈਕਟਰਸ ਨਹੀਂ ਸੀ ਯੂਜ਼ ਹੁੰਦੇ ਹੋਣ ਪ੍ਰੋਜੈਕਟਰਸ ਯੂਜ਼ ਹੋ ਰਹੇ ਨੇ ਵਾਈਟ ਬੋਰਡਸ ਆ ਗਏ ਨੇ ਬਲੈਕ ਬੋਰਡਸ ਦੀ ਜਗ੍ਹਾ 'ਤੇ ਸਕੂਲਸ ਦੇ ਵਿੱਚ ਬਾਲਾ ਵਰਕ ਹੋਣਾ ਸ਼ੁਰੂ ਹੋ ਗਿਆ ਦੈਟ ਇਜ ਰਿਅਲੀ ਗੁਡ